ਹੈਲੋ ਠੀਕ ਹੈ ਕਿਵੇਂ ਹੈ ਕਿਵੇਂ ਫੋਨ ਕੀਤਾ ਸੀ ਹੁੰ ਮੈਂ ਵੀ ਕਿਹਾ ਹੁਣੇ ਤਾਂ ਮੈਂ ਘਰੋਂ ਗਿਆ ਪਹਿਲਾਂ ਨਹੀਂ ਬੋਲਦੀ ਹੁਣ ਹੋ ਗਿਆ ਨਾ ਖਤਮ ਗੁਆਢੀਆਂ ਦੇ ਫੜ ਲਾ ਇਕ ਵਾਰ ਅ ਕੋਈ ਨਹੀਂ ਜਦੋਂ ਆ ਗਿਆ ਵਾਪਿਸ ਕਰਦਾਂਗੇ ਇੱਕ ਵਾਰ ਜਿਵੇਂ ਐਮਰਜੈਂਸੀ ਤਾਂ ਫੜ ਲਾ ਨਹੀਂ ਤਾਂ ਮੈਂ ਆ ਜਾਂਦਾ ਚੱਲ ਮੈਂ ਲਾ ਦੂੰਗਾ ਆ ਕੇ ਸਿਲੰਡਰ ਅਤੇ ਹੋਰ ਕੀ ਲਿਆਉਣਾ ਅੱਛਾ ਬਾਜ਼ਾਰੋਂ ਕੀ ਕੁਛ ਲਿਆਉਣਾ ਅੱਛਾ ਤੂੰ ਇੰਝ ਕਰ ਜਿਹੜਾ ਵੀ ਸਮਾਨ ਲਿਆਉਣਾ ਨਾ ਲਿਸਟ ਬਣਾ ਲਾ ਆਰਾਮ ਨਾਲ ਬਹਿ ਕੇ ਲਿਸਟ ਬਣਾ ਲਾ ਅਤੇ ਕੋਈ ਨਹੀਂ ਮਸਲਾ ਹੱਲ ਕਰਦੇ ਹਾਂ ਸਿਲੰਡਰ ਦਾ ਵੀ ਅਤੇ ਫਿਰ ਹੁੰ ਤਾਂ ਫਿਰ ਇੱਕੋ ਗੇੜੇ 'ਚ ਸਾਰਾ ਕੰਮ ਹੋ ਜੂਗਾ ਨਾ ਫਿਰ ਵਾਰ ਵਾਰ ਗੇੜੇ ਨਹੀਂ ਨਾ ਵੱਜਦੇ ਹਾਂ ਹੋਰ ਇੱਕ ਬਾਜ਼ਾਰਾਂ 'ਚ ਅੱਜ ਕੱਲ੍ਹ ਤੈਨੂੰ ਪਤਾ ਵੀ ਤਿਉਹਾਰ ਚੱਲਦੇ ਪਏ ਭੀੜ ਬੜੀ ਹੈ ਰਸ਼ ਹਾਂ ਮੈਨੇ ਵਿਆਹ ਦੇ ਹਾਂ ਮੌਸਮ ਖਰਾਬ ਹੈ ਅਤੇ ਵਿਆਹਾਂ ਸ਼ਾਦੀਆਂ ਦਾ ਸੀਜਨ ਹੈ ਹਰ ਇੱਕ ਦੁਕਾਨ 'ਤੇ ਤਾਂ ਰਸ਼ ਹੋਇਆ ਪਿਆ ਕਰਿਆਨੇ ਵਾਲੀ ਦੁਕਾਨ 'ਤੇ ਬਥੇਰਾ ਰਸ਼ ਹੈ ਅਤੇ ਉਹ ਜਿਹਨਾਂ ਨੇ ਵਿਆਹ ਰੱਖੇ ਉਹਨਾਂ ਨੂੰ ਰਾਸ਼ਨ ਚਾਹੀਦਾ ਸਾਰਾ ਕੁਝ ਚਾਹੀਦਾ ਤੂੰ ਆਪਣਾ ਨਾ ਛੇਤੀ ਕਰ ਲਾ ਲਿਸਟ ਬਣਾ ਲਾ ਲਿਸਟ ਬਣਾ ਲਾ ਲਿਸਟ ਬਣਾ ਕੇ ਤੇ ਮੈਨੂੰ ਦੱਸ ਦੇ ਅਤੇ ਮੈਂ ਬਸ ਮੈਂਨੂੰ ਪੰਦਰਾਂ ਵੀਹ ਮਿੰਟ ਲੱਗਣਗੇ ਮੈਂ ਆ ਜਾਂਦਾ ਹਾਂ ਹਾਂ ਹਾਂ ਉਹ ਹੀ ਨਾ ਸਬਜ਼ੀ ਸੁਬਜ਼ੀ ਬਣੀ ਹੋਊਗੀ ਤਾਂ ਰੋਟੀ ਆਪਣਾ ਦੂਜਾ ਫਿਰ ਆ ਕੇ ਫਟਾਫਟ ਬਣਾ ਲਵੇਗੀ ਮੰਮੀ ਡੈਡੀ ਹੋਰ ਮੰਮੀ ਡੈਡੀ ਨੂੰ ਭੁੱਖ ਲੱਗ ਜਾਂਦੀ ਜਲਦੀ ਹੂੰ ਆਹੋ ਤਾਂ ਹੀ ਨਾ ਫਿਰ ਮੰਡੀ ਵੀ ਜਾ ਆਵਾਂਗੇ ਮੰਡੀ ਤੋਂ ਸਬਜ਼ੀਆਂ ਵੀ ਲੈ ਆਵਾਂਗੇ ਅਤੇ ਹਾਂ ਹਫ਼ਤੇ ਦੀ ਸਬਜ਼ੀ ਦੀ ਤਾਂ ਫਿਰ ਲੇ ਆ ਹੀ ਜਾਊਗੀ ਅਤੇ ਤਾਂ ਹੀ ਤਾਂ ਕਹਿੰਦਾ ਵੇ ਲਿਸਟ ਬਣਾ ਲਾ ਆਪਣੀ ਤਾਂ ਹੀ ਇਹ ਕੰਮ ਹੈ ਤਾਂ ਮੁੜ ਕੇ ਫਿਰ ਕ ਘਰ ਆ ਕੇ ਕਹੇਂਗੀ ਆਹ ਸਮਾਨ ਲਿਆਉਣਾ ਰਹਿ ਗਿਆ ਮੇਰਾ ਆਹ ਸਾਮਾਨ ਰਹਿ ਗਿਆ ਫਿਰ ਵਾਰ ਵਾਰ ਨਹੀਂ ਗੇੜੇ ਵੱਜਦੇ ਹਾਂ ਹੋਰ ਤੈਨੂੰ ਪਤਾ ਤਾਂ ਹੈਗਾ ਅੱਜ ਕਲ੍ਹ ਪੈਟਰੋਲ ਮਹਿੰਗਾ ਹੋਇਆ ਪਿਆ ਇੱਕ ਫਿਰ ਆਉਣਾ ਜਾਣਾ ਵੀ ਕਿਹੜਾ ਸੌਖਾ ਧੁੰਦ ਵੀ ਪਈ ਜਾਂਦੀ ਜਿਵੇਂ ਮੂੰਹ ਆਪਣਾ ਅੱਖਾਂ ਕੌੜੀਆਂ ਹੋਈ ਜਾਂਦੀਆਂ ਬਾਜ਼ਾਰ 'ਚ ਜਾ ਕੇ ਹੂੰ ਬਾਹਰ ਨਿਕਲਦੇ ਤਾਂ ਅੱਖਾਂ ਕੌੜੀਆਂ ਹੁੰਦੀਆਂ ਚਲ ਠੀਕ ਹੈ ਫਿਰ ਹੈਂ ਚੰਗਾ ਮੈਂ ਆ ਜਾਂਦਾ ਤੂੰ ਲਿਸਟ ਬਣਾ ਚੰ ਓਕੇ